ਖੇਡਾਂ ਦੀ ਗੱਲ ਕਰੀਏ ਰੂਪਨਗਰ ਵਿੱਚ ਨਹਿਰੂ ਸਟੇਡੀਅਮ ਬਣਿਆ ਹੋਇਆ ਉਹਦੇ ਵਿੱਚ ਖੇਡਾਂ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਬਾਗ਼ ਬਣਿਆ ਹੋਇਆ ਹੈ ਅਤੇ ਉਹਦੇ ਵਿੱਚ ਕਾਫੀ ਕੁਛ ਬੱਚਿਆਂ ਲਈ ਖੇਡਾਂ ਦਾ ਸਮਾਨ ਲੱਗਿਆ ਹੋਇਆ ਹੈ ਝੂਲੇ ਵੀ ਲੱਗੇ ਹੋਏ ਨੇ ਖੇਡਾਂ ਦਾ ਸਮਾਨ ਬਹੁਤ ਵਧੀਆ ਲੱਗਿਆ ਹੋਇਆ ਹੈ ਉਹਦੇ ਵਿੱਚ ਬੱਚੇ ਜਾ ਕੇ ਖੇਡਦੇ ਨੇ ਵੱਡੇ ਵੀ ਅਤੇ ਸਾਰੇ ਅਸੀਂ ਉੱਥੇ ਘੁੰਮਣ ਫਿਰਨ ਲਈ ਜਾਂਦੇ ਹਾਂ ਅਤੇ ਨਾਲ਼ ਖੇਡਦੇ ਨੇ